ਭੰਗੜਾ ਵਿੱਚ ਜਾਨੀ ਕਿ ਐਕਚੁਲੀ ਸਾਰਾ ਕੁਛ ਹੋਵੇਗਾ ਯੋਗਾ ਵੀ ਹੋ ਜਾਂਦਾ ਵਾ ਅਤੇ ਭੰਗੜਾ ਵੈਸੇ ਵੀ ਅਗਰ ਪੰਜਾਬੀ ਕਰਚਰ ਹੈਗਾ ਠੀਕ ਹੈ ਅਤੇ ਭੰਗੜੇ ਦੇ ਵਿੱਚ ਜਾਨੀ ਕਿ ਆਪਣੀ ਐਕਸਰਸਾਈਜ਼ ਵਗੈਰਾ ਤਾਂ ਕੁਛ ਉਹਚ ਲੱਤਾਂ ਬਾਹਵਾਂ ਦੀ ਐਕਸਰਸਾਈਜ਼ ਵੀ ਹੋ ਜਾਂਦੀ ਹੈ ਜਾਨੀ ਕਿ ਭੰਗੜਾ ਕਾਫ਼ੀ ਚੀਜ਼ ਵਧੀਆ ਆ ਕੋਈ ਉਹ ਨਹੀਂ ਹੈਗਾ ਆਪਣਾ ਕਰਨ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਹੈਗੀ ਐਕਸਰਸਾਈਜ਼ ਵੀ ਬਹੁਤ ਵਧੀਆ ਹੁੰਦੀ ਆ ਸਰੀਰ ਸਾਰਾ ਖੁਲ੍ਹਦਾ ਰਹਿੰਦਾ ਵਾ ਸਰੀਰ ਐਕਟਿਵ ਰਹਿੰਦਾ ਸਰੀਰ ਸਾਰਾ ਦਿਹਾੜੀ ਦਾ ਐਕਟੀਵੇਟ ਰਹਿੰਦਾ ਹੈ ਭੰਗੜੇ ਵਿੱਚ ਮੇਰੇ ਘਰ ਦੇ ਵੀ ਦੇਖਦੇ ਨੇ ਹਾਂ ਵੀ ਭੰਗੜੇ ਦੇ ਤੌਰ 'ਤੇ ਆਪਣਾ ਐਕਸਰਸਾਈਜ ਕਰ ਰਿਹਾ ਬੰ ਬੱਚਾ ਸਾਡਾ ਕੋਈ ਪ੍ਰੋਬਲਮ ਨਹੀਂ ਮੈਨੂੰ ਜਦੋਂ ਮੈਂ ਕਰ ਰਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ ਵਧੀਆ ਲੱਗ ਰਿਹਾ ਵਾ ਅਤੇ ਮੈਂ ਤਾਂ ਸਾਰਿਆਂ ਨੂੰ ਇਹ ਹੀ ਕਹਿੰਦਾ ਕਿ ਹਾਂ ਵੀ ਭੰਗੜੇ ਤੌਰ 'ਤੇ ਆਪਣਾ ਐਕਸਰਸਾਈਜ਼ ਵੀ ਹੁੰਦੀ ਰਹਿੰਦੀ ਆ ਭੰਗੜਾ ਵੀ ਸਿੱਖੋ ਪੰਜਾਬੀ ਕਰਚਰ ਆ ਆਪਣਾ ਭੰਗੜੇ ਦੇ ਨਾਲ ਨਾਲ ਐਕਸਰਸਾਈਜ਼ ਹੁੰਦੀ ਬਹੁਤ ਬੈਟਰ ਹੈ ਅਤੇ ਆਪਣਾ ਸਭ ਤੋਂ ਵਧੀਆ ਚੀਜ਼ ਹੈ ਜੀ